ਤਕਨੋਲਜੀ ਰਾਹੀਂ ਫੋਟੋਆਂ ਤਾਂ ਅਸੀਂ ਬਹੁਤ ਹੀ ਆਰਾਮਦਾਇਕ ਤਰੀਕੇ ਨਾਲ ਲੈ ਸਕਦੇ ਹਾਂ ਪਰ ਇੱਕ ਚੰਗੀ ਫੋਟੋ ਖਿੱਚਣ ਦੇ ਲਈ ਸਾਨੂੰ ਅਲੱਗ ਅਲੱਗ ਤਰੀਕੇ ਦੀ ਪ੍ਰਕਿਰਿਆ ਕਰਨ ਦੀ ਪਾਲਣਾ ਕਰਨੀ ਪੈਂਦੀ ਹੈ ਜਿਵੇਂ ਕਿ ਅਸੀਂ ਇੱਕ ਚੰਗੀ ਫੋਟੋ ਖਿੱਚਣ ਦੇ ਲਈ ਇੱਕ ਵਧੀਆ ਜਗ੍ਹਾ ਨੂੰ ਅਪਣਾ ਸਕਦੇ ਹਾਂ ਜਿਵੇਂ ਕਿ ਬਾਗ ਫੁੱਲ ਜਿੱਥੇ ਦਿਖਦੇ ਹੋਣ ਜਿਵੇਂ ਕਿ ਸਾਨੂੰ ਪਿੱਛੇ ਵਸਲੇ ਦੇ ਏ ਸਾਈਟ 'ਤੇ ਪਹਾੜ ਦਿਖਾ ਸਕਦੇ ਹਾਂ ਜਿਸ ਦੇ ਨਾਲ ਫੋਟੋ ਦੇ ਵਿੱਚ ਇੱਕ ਅਲੱਗ ਹੀ ਛਵੀ ਦਿਖਦੀ ਹੈ ਔਰ ਅਸੀਂ ਫੋਟੋ ਨੂੰ ਹੋਰ ਵੀ ਵਧੀਆ ਤਰੀਕੇ ਦਾ ਦਿਖਾਉਣ ਲਈ ਅਸ ਅ ਆਰਟੀਫਿਸ਼ੀਅਲ ਲਾਈਟਾਂ ਯੂਜ਼ ਕਰ ਸਕਦੇ ਹਾਂ ਜਿਸ ਦੇ ਨਾਲ ਸਾਡਾ ਵਿੱਚ ਮਹੱਤਵ ਇਹ ਹੋਵੇਗਾ ਕਿ ਫੋਟੋ ਹੋਰ ਚੰਗੀ ਆਵੇਗੀ ਅਤੇ ਉਭਰ ਕੇ ਆਵੇਗੀ ਚੰਗੀ ਫੋਟੋ ਨੂੰ ਹੋਰ ਵੀ ਵਧੀਆ ਤਰੀਕੇ ਦੀ ਦਿਖਾਉਣ ਦੇ ਕਾਰਨ ਅਸੀਂ ਉਸ ਨੂੰ ਹੋਰ ਵੀ ਅਲੱਗ ਅਲੱਗ ਤਰੀਕੇ ਦੀ ਜਗ੍ਹਾਵਾਂ ਤੋਂ ਖਲੋ ਕੇ ਖਿੱਚ ਸਕਦੇ ਹਾਂ ਜਿਵੇਂ ਕਿ ਅਲੱਗ ਅਲੱਗ ਐਂਗਲ 'ਤੇ ਖੜ੍ਹੇ ਹੋ ਕੇ ਅਤੇ ਵੱਖਰੀ ਵੱਖਰੀ ਲਾਈਟਿੰਗ ਦੇਖ ਕੇ ਅਸੀਂ ਉਸ ਫੋਟੋ ਨੂੰ ਖਿੱਚ ਸਕਦੇ ਹਾਂ ਅਤੇ ਆਪਣੀ ਫੋਟੋ ਨੂੰ ਹੋਰ ਵੀ ਵੱਖਰੇ ਭਾਵ ਦੀ ਦਿਖਾ ਸਕਦੇ ਹਾਂ